ਹਾਂ ਇਹ ਸਾਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਖੇਤੀਬਾੜੀ ਵਿੱਚ ਉਲਝਣਾ ਪਸੰਦ ਨਹੀਂ ਕਰਦੇ ਕਿਉਂਕਿ ਖੇਤੀਬਾੜੀ 'ਚੋਂ ਕੁਛ ਬਚਦਾ ਨਹੀਂ ਹੈਗਾ ਮਤਲਬ ਕਿ ਫਸਲ ਦਾ ਰੇਟ ਸਰਕਾਰ ਬਹੁਤ ਜ਼ਿਆਦਾ ਘੱਟ ਦੇ ਰਹੀ ਹੈ ਮਿਹਨਤ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਰੇਹਾਂ ਸਪਰੇਹਾਂ ਦੀ ਮਤਲਬ ਕਿ ਜਿਹੜੀਆਂ ਰਸਾਇਣਿਕ ਖਾਦਾਂ ਵਗੈਰਾ ਨੇ ਉਹ ਬਹੁ ਉਹਨਾਂ ਦੀ ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਕਿਸਾਨ ਨੂੰ ਬੈਨੀਫਿਟ ਬਹੁਤ ਜ਼ਿਆਦਾ ਘੱਟ ਹੋ ਰਿਹਾ ਅਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈ ਰਹੀ ਹੈ ਇਸ ਕਰਕੇ ਉਨ ਉਹਨਾਂ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋ ਰਿਹਾ ਫਸਲ ਦੀਆਂ 'ਚ ਮਤਲਬ ਕਿ ਇਸ ਕਰਕੇ ਉਹ ਖੇਤੀ ਵਿੱਚ ਉਲਝਣਾ ਪਸੰਦ ਨਹੀਂ ਕਰਦੇ ਉਹ ਕਹਿੰਦੇ ਹਨ ਮਤਲਬ ਕਿ ਦੂਜੀ ਹੋਰ ਕੋਈ ਜੋਬ ਲੱਗ ਕੇ ਮਹੀਨੇ ਮਹੀਨੇ ਮਹੀਨੇ ਆਮਦਨ ਆਉਂਦੀ ਹੈ ਤਾਂ ਉਸ ਵਿੱਚ ਹੀ ਗੁਜ਼ਾਰਾ ਕਰਨਾ ਪਸੰਦ ਕਰਦੇ ਹਨ ਉਹਨਾਂ ਦਾ ਪਰਿਵਾਰ ਹੈ ਪਰਿਵਾਰ ਦੇ ਤੁਸੀਂ ਇਸ ਵਾਰੀ ਇਸ ਅਸੀਂ ਇਸ ਵਾਰੀ ਇਹ ਸੋਚਦੇ ਹਾਂ ਕਿ ਖੇ ਕਿ ਖੇਤੀ ਕਰਨੀ ਵੀ ਚਾਹੀਦੀ ਹੈ ਅਤੇ ਖੇਤੀ ਬਿਨਾ ਕਿਸਾਨ ਦਾ ਗੁਜ਼ਾਰਾ ਨਹੀਂ ਖੇਤੀਬਾੜੀ ਦੀ ਸਾਡੇ ਕਿਸਾਨ ਦੇ ਕਿਸਾਨੀ ਮਹਿਕਮੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਕਿਉਂਕਿ ਖੇਤੀਬਾੜੀ ਤੋਂ ਬਿਨਾਂ ਕਿਸਾਨ ਅਧੂਰਾ ਹੈ ਖੇਤੀਬਾੜੀ ਜ਼ਮੀਨ ਨਾਲ ਹੀ ਜ਼ਮੀਨ ਉਸਦੀ ਮਾਂ ਹੈ ਉਸ ਤੋਂ ਬਿਨਾਂ ਕਿਸਾਨ ਬਹੁਤ ਜ਼ਿਆਦਾ ਅਧੂਰਾ ਹੈ ਪਰ ਇਸ ਦੀਆਂ ਸਰਕਾਰ ਨੂੰ ਚਾਹੀਦਾ ਹੈ ਕਿ ਕੀਮਤਾਂ ਵਧਾਉਣੀਆਂ ਚਾਹੀਦੀਆਂ ਹਨ ਉਹਨਾਂ ਦੀ ਮਿਹਨਤ ਦਾ ਮੁੱਲ ਪਾਉਣਾ ਚਾਹੀਦਾ ਹੈ ਅਤੇ ਇਸਦੇ ਬਿਨਾਂ ਜੋ ਖੇ ਖੇਤੀਬਾੜੀ ਜੇ ਕਿਸਾਨ ਖੇਤੀਬਾੜੀ ਨਹੀਂ ਕਰਨਗੇ ਤਾਂ ਉਹਨਾਂ ਦੀਆਂ ਮਤਲਬ ਕਿ ਜੋ ਆਪਾਂ ਖਾਣਾ ਖਾਵਾਂਗੇ ਉਹ ਕਿੱਥੋਂ ਖਾਵਾਂਗੇ ਜਿਹੜੀਆਂ ਮਤਲਬ ਕਿ ਮੁੱਲ ਦੀਆਂ ਚੀਜ਼ਾਂ ਆ ਰਹੀਆਂ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਮਿਲਾਵਟ ਆ ਰਹੀ ਹੈ ਉਹ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣਗੀਆਂ ਅਤੇ ਇਹ ਨੁਕਸਾਨ ਪਹੁੰਚਾਉਣਗੀਆਂ ਸਾਨੂੰ ਬਿਮਾਰੀਆਂ ਲੱਗਣਗੀਆਂ ਅਤੇ ਇਸ ਹੋਰ ਦਵਾਈਆਂ ਦਾ ਸ਼ਿਕਾਰ ਬਣਾਂਗੇ ਤਾਂ ਹੋਰ ਜ਼ਿਆਦਾ ਮਤਲਬ ਕਿ ਹੋਣਗੇ ਤਾਂ ਇਸ ਕਰਕੇ ਹੀ ਕਿਸਾਨ ਖੁਦਕੁਸ਼ੀ ਵੀ ਕਰ ਰਿਹਾ ਕਿਉਂਕਿ ਉਨ੍ਹਾਂ ਦੀ ਕੀ ਫਸਲ ਦੀ ਕੀਮਤ ਪੂਰੀ ਨਹੀਂ ਮਿਲ ਰਹੀ ਉਸਨੂੰ ਇਸ ਕਰਕੇ ਕਿ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਵਾਸਤੇ ਕੁਛ ਅਹਿਮੀਅਤ ਅਲੱਗ ਤੋਂ ਕੁਛ ਹੋਰ ਵਧੀਆ ਕਰੇ ਤਾਂ ਜੋ ਕਿਸਾਨ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਵੀ ਖੇਤੀਬਾੜੀ 'ਚ ਇੰਟਰਸਟ ਹੋਵੇ ਪਹਿਲੇ ਬਜ਼ੁਰਗ ਹੀ ਖੇਤੀਬਾੜੀ ਕਰਦੇ ਨੇ ਅਤੇ ਉਹ ਅੱਜ ਕੱਲ੍ਹ ਦੇ ਹੁਣ ਦੇ ਨੌਜਵਾਨ ਖੇਤੀਬਾੜੀ ਨੂੰ ਮਹੱਤਤਾ ਬਹੁਤ ਜ਼ਿਆਦਾ ਘੱਟ ਦਿੰਦੇ ਨੇ ਇਸ ਕਰਕੇ ਸਰਕਾਰ ਨੂੰ ਕੋਈ ਇਹੋ ਜਿਹੀ ਨਵੀਂ ਨੀਤੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਨਵੇਂ ਨੌਜਵਾਨ ਵੀ ਹੁਣ ਦੀ ਖੇਤੀਬਾੜੀ ਵਿੱਚ ਇੰਟਰਸਟ ਵਧੇ